ਸਾਡੇ ਪਿੰਡ ਦਾ ਡਰੇਨੇਜ ਸਿਸਟਮ ਬਿਲਕੁਲ ਬੇਕਾਰ ਹੋ ਚੁੱਕਿਆ ਹੈ ਇਹ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਹੈ ਇਹ ਬੜੇ ਪੁਰਾਣੇ ਤਰੀਕੇ ਨਾਲ ਬਣਿਆ ਹੋਇਆ ਹੈ ਜਦੋਂ ਵੀ ਬਾਰਿਸ਼ਾਂ ਆਉਂਦੀਆਂ ਹਨ ਤਾਂ ਸਾਰਾ ਸਿਸਟਮ ਫੇਲ ਹੋ ਜਾਂਦਾ ਹੈ ਡਰੇਨੇਜ ਸਿਸਟਮ ਨੂੰ ਸੁਧਾਰਨ ਲਈ ਅਸੀਂ ਵਾਰ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨਾਂ ਉੱਪਰ ਅਜੇ ਤੱਕ ਕੋਈ ਵੀ ਜੂੰ ਨਹੀਂ ਸਰਕੀ ਹੈ ਅਸੀਂ ਚਾਹੁੰਦੇ ਹਾਂ ਕਿ ਡਰੇਨੇਜ ਸਿਸਟਮ ਨਵੇਂ ਸਿਰਿਓਂ ਬਣਾਇਆ ਜਾਵੇ ਤਾਂ ਕਿ ਪਿੰਡ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਤੁਸੀਂ ਜਾਣਦੇ ਹੀ ਹੋ ਕਿ ਸਾਫ਼ ਸੁਥਰੀ ਜਗ੍ਹਾ 'ਤੇ ਰੱਬ ਦਾ ਨਿਵਾਸ ਹੁੰਦਾ ਹੈ ਪਰ ਜਿੱਥੇ ਡਰੇਨੇਜ ਹੀ ਸਹੀ ਢੰਗ ਨਾਲ ਨਾ ਹੋਵੇ ਉੱਥੇ ਰੱਬ ਤਾਂ ਕੀ ਜਾਨਵਰ ਵੀ ਬਹਿਣਾ ਪਸੰਦ ਨਹੀਂ ਕਰਦੇ ਹਨ ਤੁਸੀਂ ਆਪ ਜਾਣਦੇ ਹੋ ਕਿ ਸਫਾਈ ਸਾਡੇ ਲਈ ਕਿੰਨੀ ਜ਼ਰੂਰੀ ਹੈ ਸਾਫ਼ ਸਫਾਈ ਤੋਂ ਬਿਨ੍ਹਾਂ ਤਾਂ ਕਿਤੇ ਰਹਿਣਾ ਬਹੁਤ ਹੀ ਮੁਸ਼ਕਿਲ ਕੰਮ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਜ਼ਰੂਰ ਚੁੱਕੋਗੇ ਤਾਂ ਕਿ ਸਾਡੇ ਪਿੰਡ ਦਾ ਵਾਤਾਵਰਣ ਸਾਫ਼ ਸੁਥਰਾ ਬਣ ਸਕੇ ਅਤੇ ਉੱਥੇ ਚਲਣਾ ਫਿਰਨਾ ਵੀ ਆਸਾਨ ਹੋਵੇ